ਜਦੋਂ ਮੈਂ ਘਰ ਵਿੱਚ ਕੋਈ ਕੰਮ ਕਰਦੀ ਹਾਂ ਤਾਂ ਮੈਂ ਕ ਕੋਈ ਕੰਮ ਕਰਦੀ ਹੋਈ ਮੈਂ ਆਪਣੇ ਕੰਨਾਂ ਵਿੱਚ ਹੈੱਡਫੋਨ ਪਾ ਲੈਂਦੀ ਹਾਂ ਅਤੇ ਮੈਂ ਸੋਂਗ ਸੁਣਦੀ ਹਾਂ ਇਸ ਨਾਲ ਮੇਰਾ ਮਨੋਰੰਜਨ ਵੀ ਹੁੰਦਾ ਹੈ ਕਈ ਵਾਰ ਮੈਂ ਸੋਂਗ ਖੁਦ ਹੀ ਗਾ ਲੈਂਦੀ ਹਾਂ ਕੰਮ ਕਰਦੀ ਕਰਦੀ ਮੈਂ ਸੋਂਗ ਗਾ ਲੈਂਦੀ ਹਾਂ ਇਸ ਨਾਲ ਮੇਰਾ ਮਨੋਰੰਜਨ ਹੋ ਜਾਂਦਾ ਹੈ ਅਤੇ ਮੇਰਾ ਕੰਮ ਵੀ ਜਲਦੀ ਹੋ ਜਾਂਦਾ ਹੈ ਖੇਤਾਂ ਵਿੱਚ ਕੰਮ ਕਰਦੇ ਸਮੇਂ ਵੀ ਮੈਂ ਖੁਦ ਸੋਂਗ ਗਾ ਲੈਂਦੀ ਹਾਂ ਇਸ ਨਾਲ ਮੇਰਾ ਮਨੋਰੰਜਨ ਹੋ ਜਾਂਦਾ ਹੈ ਅਤੇ ਕੰਮ ਵੀ ਜਲਦੀ ਅਤੇ ਅਸਾਨੀ ਨਾਲ ਹੋ ਜਾਂਦਾ ਹੈ